ਮੈਂ ਬਹੁਤ ਵਾਰ ਪੰਛੀ ਦੇਖਣ ਗਈ ਅਤੇ ਮੈਨੂੰ ਯਾਦ ਹੈ ਕਿ ਮੈਂ ਇੱਕ ਜਦੋਂ ਪੰਛੀ ਦੇਖਣ ਗਈ ਸੀ ਤਾਂ ਮੈਂ ਇੱਕ ਅਸਧਾਰਨ ਪੰਛੀ ਦੇਖਿਆ ਸੀ ਜਿਸ ਨੂੰ ਬਲੀਨ ਬਰਡ ਦੀ ਕਿਹਾ ਜਾਂਦਾ ਹੈ ਅਤੇ ਇੱਕ ਨੂੰ ਛੋਟਾ ਜਿਹਾ ਪੰਛੀ ਸੀ ਜੋ ਆਮ ਤੌਰ 'ਤੇ ਦੇਖਿਆ ਅਤੇ ਇਸੇ ਏਸ਼ੀਆ ਦੇ ਜੰਗਲਾਂ ਵਿੱਚ ਮਿਲਦਾ ਹੈ ਇਹ ਇਹ ਰੰਗ ਬਰੰਗਾ ਅਤੇ ਪੰਛੀ ਹੁੰਦਾ ਹੈ ਇਹ ਰੰਗ ਬਰੰਗਾ ਹੀ ਹੁੰਦਾ ਹੈ ਸਭ ਤੋਂ ਛੋਟਾ ਵੱਖਰਾ ਹੁੰਦਾ ਹੈ ਅਤੇ ਇਸਦੀ ਸੰਖਿਆ ਘੱਟ ਹੈ ਕਿ ਜਿਵੇਂ ਇਹ ਕਦੇ ਵੀ ਕਦੇ ਹੀ ਦਿਸਦਾ ਹੈ ਜਦੋਂ ਵੀ ਪੰਛੀ ਦੇਖਿਆ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਸੀ ਆਪਣੇ ਹੀ ਜੀ ਕਿਸਮਤ ਆਪ ਨੂੰ ਕਿਸਮਤ ਵਾਲੀ ਮੰਨਿਆ ਕਿਉਂਕਿ ਇਹ ਪੰਛੀ ਕਿਸੇ ਨੂੰ ਦੇਖਣ ਨੂੰ ਮਿਲਦਾ ਹੈ ਨਾਲ ਹੀ ਮੇਰੇ ਪਰਿਵਾਰ ਦੇਖਣ ਗਿਆ ਸੀ ਪੰਛੀ ਬਹੁਤ ਹੀ ਪੰਛੀ ਬਹੁਤ ਹੀ ਪਰਿਵਾਰ ਨੂੰ ਦੇਖਿਆ ਸੀ ਸੀ ਮੇਰੇ ਸਾਰੇ ਪਰਿਵਾਰ ਨੂੰ ਇਹ ਪੰਛੀ ਦੇਖਣ ਨੂੰ ਬਹੁਤ ਖੁਸ਼ੀ ਹੋਈ ਸੀ ਅਤੇ ਸਭ ਤੋਂ ਫਿਰ ਪੰਛੀ ਦੇਖਣ ਬਾਰੇ ਸੋਚਿਆ ਤਾਂ ਸਾਨੂੰ ਨਹੀਂ ਦਿਖਿਆ